ਮਾਰਸ਼ਲ ਆਰਟ ਔਰਤਾਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਦਾ ਦੌਰ ਇਹੋ ਜਿਹਾ ਹੈ ਕਿ ਜੇ ਔਰਤ ਆਪਣੇ ਆਪ ਦੀ ਰੱਖਿਆ ਨਹੀਂ ਕਰ ਸਕਦੀ ਤਾਂ ਉਹ ਕਿਸੇ ਦੀ ਵੀ ਰੱਖਿਆ ਨਹੀਂ ਕਰ ਸਕਦੀ ਇਸ ਕਰਕੇ ਉਹਨੂੰ ਆਪਣੇ ਆਪ ਨੂੰ ਸਾ ਸੰਭਾਲ ਕੇ ਰੱਖਣ ਲਈ ਕਹਿ ਦੇਈਏ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਵਾਸਤੇ ਜ਼ਰੂਰੀ ਹੈ ਕਿ ਉਹਨੂੰ ਮਾਰਸ਼ਲ ਆਰਟ ਵਰਗੀਆਂ ਤਕਨੀਕਾਂ ਆਉਣ ਕਿਉਂਕਿ ਅੱਜ ਦੇ ਦੌਰ ਵਿੱਚ ਔਰਤ ਨੂੰ ਨੌਕਰੀ ਵਾਸਤੇ ਬਾਹਰ ਵੀ ਜਾਣਾ ਪੈਂਦਾ ਹੈ ਕਿਤੇ ਇਕੱਲੇ ਵੀ ਰਹਿਣਾ ਪੈਂਦਾ ਹੈ ਅਗਰ ਉਹਨੂੰ ਇਹੋ ਜਿਹੀਆਂ ਤਕਨੀਕਾਂ ਆਉਂਦੀਆਂ ਹੋਣਗੀਆਂ ਅਤੇ ਜੇ ਕਿਤੇ ਉਹਨੂੰ ਅਸੁਵਿਧਾ ਲੱਗਦੀ ਹੈ ਤਾਂ ਉਹ ਮਾਰਸ਼ਲ ਆਰਟ ਵਰਗੀ ਤਕਨੀਕ ਨੂੰ ਯੂਜ਼ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਕਰ ਸਕਦੀ ਹੈ ਅਗਰ ਕਿਉਂਕਿ ਹ ਅੱਜ ਦੇ ਦੌਰ ਦੇ ਵਿੱਚ ਇਹ ਜ਼ਰੂਰੀ ਨਹੀਂ ਕਿ ਅਸੀਂ ਔਰਤ ਜਾਂ ਇੱਕ ਕੁੜੀ ਦੇ ਨਾਲ ਹਮੇਸ਼ਾ ਰਹਿ ਰਹਿ ਸਕੀਏ ਕਿਉਂਕਿ ਕੰਮ ਕਾਰ ਦੀ ਵਜ੍ਹਾ ਕਰਕੇ ਸਾਨੂੰ ਕਿਤੇ ਨਾ ਕਿਤੇ ਬਾਹਰ ਵੀ ਜਾਣਾ ਪੈਂਦਾ ਹੈ ਕਿਤੇ ਇਕੱਲੇ ਵੀ ਰਹਿਣਾ ਪੈਂਦਾ ਹੈ ਇਹੋ ਜਿਹੀ ਹਾਲਤ ਦੇ ਵਿੱਚ ਸਾਨੂੰ ਆਪਣੀ ਸਵੈ ਰੱਖਿਆ ਖੁਦ ਕਰਨੀ ਚਾਹੀਦੀ ਵੀ ਹੈ ਤੇ ਸਾਨੂੰ ਆਉਣੀ ਵੀ ਚਾਹੀਦੀ ਹੈ ਕਿਉਂਕਿ ਹ ਅਸੀਂ ਹਮੇਸ਼ਾ ਆਪਣੇ ਆ ਕਿ ਆਪਣੇ ਆਪ ਨੂੰ ਕਿਸੇ 'ਤੇ ਨਿਰਭਰ ਕਰਕੇ ਨਹੀਂ ਰੱਖ ਸਕਦੇ ਕਿਉਂਕਿ ਸਮਾਂ ਇੱਕ ਅ ਸਮਾਂ ਕਹਿ ਦੇਈਏ ਇੱਕ ਇਹੋ ਜਿਹੀ ਮੰਗ ਕਰ ਰਿਹਾ ਔਰਤਾਂ ਵਾਸਤੇ ਕਿ ਉਹ ਆਪਣੇ ਪੈਰਾਂ ਸਿਰ ਖੜ੍ਹੇ ਹੋ ਕੇ ਆਪਣੀ ਰੱਖਿਆ ਖੁਦ ਕਰਨੀ ਸਿੱਖਣ ਉਹਨਾਂ ਨੂੰ ਹਮੇਸ਼ਾ ਕਿਸੇ 'ਤੇ ਨਿਰਭਰ ਨਾ ਹੋਣਾ ਪਵੇ ਕਿ ਕੋਈ ਮੇਰੀ ਮਦਦ ਕਰੂਗਾ ਤਾਂ ਮੈਨੂੰ ਬਚਾਊਗਾ ਕਿਉਂਕਿ ਆਪਾਂ ਜਾਣਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਕੁਛ ਮੈਲ ਲੋਕ ਵੀ ਹੁੰਦੇ ਹੈ ਜਿਹਨਾਂ ਦੀ ਸੋਚ ਜਿਹਨਾਂ ਦੀ ਸਿੱਖਿਆ ਸਹੀ ਨਹੀਂ ਹੁੰਦੀ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਔਰਤ ਨੂੰ ਆਤਮ ਨਿਰਭਰ ਹੋਣ ਵਾਸਤੇ ਸਵੈ ਰੱਖਿਆ ਵਾਸਤੇ ਮਾਰਸ਼ਲ ਆਰਟ ਵਰਗੀਆਂ ਚੀਜ਼ਾਂ ਸਿੱਖਣੀਆਂ ਹੀ ਪੈਣਗੀਆਂ ਕਿਉਂਕਿ ਇਹਨਾਂ ਤੋਂ ਬਿਨਾਂ ਉਹ ਆਪਣੇ ਆਪਣੇ ਵਜੂਦ ਨੂੰ ਸਾਬਤ ਵੀ ਨਹੀਂ ਕਰ ਸਕਦੀ ਅਤੇ ਆਪਣੇ ਆਪ ਨੂੰ ਸੁਰੱਖਿਅਤ ਵੀ ਨਹੀਂ ਰੱਖ ਸਕਦੀ ਕਿ ਜੇ ਅਸੀਂ ਵਾਰ ਵਾਰ ਆਪਣੀ ਮਦਦ ਲਈ ਕਿਸੇ ਨੂੰ ਬੁਲਾਵਾਂਗੇ ਕੋਈ ਇਨਸਾਨ ਆਪਣੀ ਮਦਦ ਕਦੋਂ ਤੱਕ ਕਰ ਸਕਦਾ ਹੈ ਇੱਕ ਵਾਰ ਕਰੇਗਾ ਦੋ ਵਾਰ ਕਰੇਗਾ ਪਰ ਆਖਰ ਵਿੱਚ ਸਾਨੂੰ ਆਪਣੀ ਮਦਦ ਖੁਦ ਹੀ ਕਰਨੀ ਪੈਣੀ ਹੈ ਇਸ ਕਰਕੇ ਮੇਰਾ ਇਹ ਮੰਨਣਾ ਹੈ ਕਿ ਔਰਤ ਲਈ ਸਭ ਤੋਂ ਜ਼ਰੂਰੀ ਹੈ ਮਾਰਸ਼ਲ ਆਰਟ ਵਰਗੀਆਂ ਚੀਜ਼ਾਂ ਨੂੰ ਸਿੱਖਣਾ